ਭਾਰਤ ਵਿੱਚ ਬਹੁਤ ਤਰ੍ਹਾਂ ਦੇ ਸੱਭਿਆਚਾਰ ਹਨ ਜਿਵੇਂ ਪੰਜਾਬ ਵਿੱਚ ਖੇਡ ਮੇਲੇ ਹੋਏ ਤਿਉਹਾਰ ਹੋਏ ਕਿਸੇ ਜਗ੍ਹਾ 'ਤੇ ਲੋਕ ਨਾਚ ਹੈ ਕਿਸੇ ਜਗ੍ਹਾ ਤੇ ਕਥਾਵਾਂ ਹਨ ਇਹ ਸਾਰੇ ਹੀ ਇੱਕ ਕੁੱਲ ਮਿਲਾ ਕੇ ਇੱਕ ਸੱਭਿਆਚਾਰ ਦਾ ਹਿੱਸਾ ਹਨ ਕਿਤੇ ਤੀਰਥਾਂ 'ਤੇ ਜਾਣਾ ਯਾਤਰਾ ਕਰਨਾ